ਮੈਂ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲਿਆ ਹੈ ਸਕੂਲ ਵਿੱਚ ਜਦੋਂ ਦਿਵਾਲੀ ਦਾ ਤਿਉਹਾਰ ਆਇਆ ਤਾਂ ਸਭ ਨੇ ਵੱਖੋ ਵੱਖਰੀਆਂ ਆਈਟਮਾਂ ਤਿਆਰ ਕੀਤੀਆਂ ਉਸੇ ਟਾਈਮ ਮੇਰਾ ਵੀ ਗਾਉਣ ਦਾ ਸ਼ੌਂਕ ਸੀ ਅਤੇ ਮੈਂ ਵੀ ਸਿੰਗਿੰਗ ਵਿੱਚ ਪਾਰਟੀਸਪੇਟ ਕੀਤਾ ਸਾਰੇ ਹੀ ਬਹੁਤ ਨਿਖਰ ਭੁਖਰ ਕੇ ਆਏ ਸਨ ਉਹ ਬਹੁਤ ਖੁਸ਼ ਸਨ ਕਿਉਂਕਿ ਸਾਡੇ ਸਕੂਲ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਾਰੇ ਹੀ ਅਧਿਆਪਕ ਉਸ ਦਿਨ ਬਹੁਤ ਖੁਸ਼ ਹੁੰਦੇ ਹਨ ਇਸੇ ਦਿਨ ਹੀ ਮੈਂ ਆਪਣੇ ਦੋਸਤਾਂ ਨਾਲ ਕਿਤੇ ਘੁੰਮਣ ਜਾਣਾ ਸੀ ਪਰ ਮੈਂ ਉਹਨਾਂ ਨੂੰ ਮਨ੍ਹਾਂ ਕਰ ਦਿੱਤਾ ਕਿਉਂਕਿ ਮੈਨੂੰ ਗਾਉਣਾ ਬਹੁਤ ਵਧੀਆ ਲੱਗਦਾ ਸੀ ਜਿਸ ਨਾਲ ਮੈਨੂੰ ਖੁਸ਼ੀ ਮਿਲਦੀ ਸੀ ਇਸ ਕਰਕੇ ਮੈਂ ਉਹਨਾਂ ਦੇ ਨਾਲ ਨਹੀਂ ਗਿਆ ਅਤੇ ਆਪਣੇ ਇਸ ਪਾਰਟੀਸਪੈਂਟ ਵਾਸਤੇ ਉੱਥੇ ਹੀ ਰੁਕ ਗਿਆ ਜਦੋਂ ਸ਼ੁਰੂਆਤ ਹੋਈ ਤਾਂ ਸਭ ਨੇ ਕਿਸ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਉੱਥੇ ਬਹੁਤ ਸਾਰੇ ਐਮ ਐਲ ਏ ਜਿਵੇਂ ਸ਼੍ਰੀ ਨਰੇਸ਼ ਕਟਾਰੀਆ ਅਤੇ ਸਾਬਕਾ ਐਮ ਐਲ ਏ ਵੀ ਪਹੁੰਚੇ ਹੋਏ ਸਨ ਸਾਰੇ ਹੀ ਬਹੁਤ ਖੁਸ਼ ਸਨ ਉੱਥੇ ਹੀ ਸਾਡੇ ਅਧਿਆਪਕ ਜੀ ਨੇ ਵੀ ਬਹੁਤ ਕੁਝ ਬੋਲਿਆ ਅਤੇ ਸਾਨੂੰ ਉਹਨਾਂ ਦੀ ਸਿੱਖਿਆ ਬਹੁਤ ਵਧੀਆ ਲੱਗੀ ਉਸੇ ਟਾਈਮ ਮੇਰੀ ਵਾਰੀ ਆ ਗਈ ਅਤੇ ਮੈਂ ਗਾਉਣ ਲੱਗ ਪਿਆ ਜਦੋਂ ਮੈਂ ਗਾਇਆ ਤਾਂ ਸਾਰੇ ਹੀ ਭਾਵੁਕ ਹੋ ਗਏ ਉਹਨਾਂ ਨੂੰ ਮੇਰਾ ਗਾਉਣਾ ਇੰਨਾਂ ਵਧੀਆ ਲੱਗਾ ਕਿ ਉਹਨਾਂ ਨੇ ਮੈਨੂੰ ਇਨਾਮ ਵੀ ਦਿੱਤਾ ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੈਂ ਜਦੋਂ ਵੀ ਗਾਉਂਦਾ ਸੀ ਤਾਂ ਮੇਰੇ ਅਧਿਆਪਕ ਮੈਨੂੰ ਬਹੁਤ ਹੱਲਾਸ਼ੇਰੀ ਦਿੰਦੇ ਸਨ ਇਸ ਖੁਸ਼ੀ ਕਾਰਨ ਮੈਂ ਉਹਨਾਂ ਦੀ ਹਰ ਗੱਲ ਮੰਨਦਾ ਸੀ ਅਤੇ ਉਹਨਾਂ ਦੇ ਕਹਿਣ 'ਤੇ ਚੱਲਦਾ ਸੀ ਮੇਰੇ ਅਧਿਆਪਕ ਵੀ ਮੇਰੇ ਤੋਂ ਬਹੁਤ ਖੁਸ਼ ਸਨ ਇਸ ਕਰਕੇ ਉਹਨਾਂ ਨੇ ਮੈਨੂੰ ਹਰ ਫੰਕਸ਼ਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਮੈਂ ਉਹਨਾਂ ਦੀ ਹਰ ਸਿੱਖਿਆ 'ਤੇ ਚੱਲਦਾ ਹਾਂ ਧੰਨਵਾਦ